ਬ੍ਰਹਿਮੰਡ ਦੇ ਵਿੱਚ ਅਜੇ ਅਜਿਹੀਆਂ ਚੀਜ਼ਾਂ ਬਾਕੀ ਹਨ ਜਿਨ੍ਹਾਂ ਦੇ ਵਾਰੇ ਹਜੇ ਤੱਕ ਜਿਹੜੀ ਆ ਸਾਇੰਸ ਤਾਂ ਉੱਥੋਂ ਤੱਕ ਨਹੀਂ ਪਹੁੰਚ ਪਾਈ ਬੇਸ਼ੱਕ ਵੱਧਦੇ ਅਤੇ ਡਿਵੈਲਪਮੈਂਟ ਦੇ ਕਾਰਣ ਤਰੱਕੀ ਤਾਂ ਬੇਸ਼ਕ ਦੇਸ਼ਾਂ ਨੇ ਦੁਨੀਆਂ ਨੇ ਕਰ ਲਈ ਹੈ ਪਰ ਹਜੇ ਵੀ ਕੁਦਰਤ ਦੇ ਵਿੱਚ ਅਜਿਹੇ ਚਿੰਨ੍ਹ ਅਤੇ ਐਹ ਬਾਕੀ ਹਨ ਜਿਸ ਦੇ ਵਿੱਚ ਕਿ ਨੇ ਬ੍ਰਹਿਮੰਡ ਦੇ ਬਹੁਤ ਸਾਰੇ ਰਾਜ ਜਿਹੜੇ ਨੇ ਉਜਾਗਰ ਹੋਣ ਤੋਂ ਬਾਕੀ ਨੇ ਕਿਉਂਕਿ ਹਜੇ ਤੱਕ ਇਨਾ ਵੀ ਵਿਕਾਸ ਨਹੀਂ ਹੋਇਆ ਕਿ ਪੂਰੇ ਯੂਨੀਵਰਸ ਪੂਰੇ ਬ੍ਰਹਮੰਡ ਦੇ ਵਿੱਚੋਂ ਕੁਝ ਅਜਿਹੀਆਂ ਚੀਜ਼ਾਂ ਖੋਜੀਆਂ ਨਹੀਂ ਗਈਆਂ ਹਨ ਤਾਂ ਜਿਵੇਂ ਅਸੀਂ ਉਦਾਹਰਣ ਲੈ ਸਕਦੇ ਹਾਂ ਬਲੈਕ ਹੋਲ ਦੀ ਜੇ ਅਸੀਂ ਦੇਖਿਆ ਜਾਵੇ ਤਾਂ ਇੱਕ ਅਸੀਂ ਬਲੈਕ ਹੋਲ ਦੇ ਬਾਰੇ ਗੱਲ ਕਰੀਏ ਤਾਂ ਬ੍ਰਹਿਮੰਡ ਦੇ ਵਿੱਚ ਬਹੁਤ ਸਾਰੇ ਗ੍ਰਹਿ ਹਨ ਤਾਂ ਉਹਨਾਂ ਦੇ ਵਿੱਚ ਅਨੇਕਾਂ ਹੀ ਗਲੈਕਸੀਆਂ ਹਨ ਤਾਂ ਅਸੀਂ ਦੇਖੀਏ ਤਾਂ ਉਹਦੇ ਵਿੱਚੋਂ ਇੱਕ ਬੜੀ ਹੀ ਬਰੀਕ ਅਤੇ ਇੱਕ ਹੀ ਫੋਟੋ ਜਿਸ ਦੀ ਮਿਲੀ ਹੈ ਉਹ ਹੈ ਬਲੈਕ ਹੋਲ ਤਾਂ ਬਲੈਕ ਹੋਲ ਅਸੀਂ ਸਿਰਫ਼ ਉਸਨੂੰ ਆਖਦੇ ਹਾਂ ਜਿਸ ਦੇ ਵਿੱਚ ਉਸਦਾ ਮਾਸ ਹੈ ਜੋ ਉਸਦਾ ਵਜਨ ਹੈ ਡੈਂਸਟੀ ਹੈ ਬਹੁਤ ਜ਼ਿਆਦਾ ਵਧਣ ਦੇ ਕਰਕੇ ਉਹਦੇ ਵਿੱਚ ਗ੍ਰੈਵਿਟੀ ਜ਼ਿਆਦਾ ਵੱਧ ਜਾਂਦੀ ਹੈ ਅਤੇ ਉਸ ਨੂੰ ਉਸ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਓਬਜਰਵ ਕੀਤ ਕਰ ਲਈਆਂ ਜਾਂਦੀਆਂ ਨੇ ਉਹਦੇ ਉਸ ਦੇ ਵਿੱਚ ਪ੍ਰਕਾਸ਼ ਵੀ ਨਹੀਂ ਗੁਜਰ ਸਕਦਾ ਤਾਂ ਇਹ ਬੇਸ਼ੱਕ ਇਸ ਦੀ ਖੋਜ ਕੀਤੀ ਤਾਂ ਹੈ ਪਰ ਇਹ ਅਜੇ ਵੀ ਅਧੂਰੀ ਹੈ ਜਿਵੇਂ ਅਸੀਂ ਹੋਰ ਵੀ ਉਦਾਹਰਣਾ ਲਈਏ ਤਾਂ ਜਿਵੇਂ ਸਾਡੀ ਗਲੈਕਸੀ ਹੈ ਸਾਡਾ ਬ੍ਰਹਿਮੰਡ ਹੈ ਮਿਲਕੀ ਵੇ ਤਾਂ ਮਿਲਕੀ ਵੇ ਤੋਂ ਵੀ ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਗਲੈਕਸੀਆਂ ਨੇ ਜਿਨਾਂ ਦੀ ਖੋਜ ਹਜੇ ਤੱਕ ਦੁਨੀਆਂ ਵਿੱਚ ਨਹੀਂ ਹੋ ਸਕੀ ਤਾਂ ਉਮੀਦ ਹੈ ਵਾਧੇ ਵਿਕਾਸ ਦੇ ਕਾਰਣ ਆਉਂਦੀ ਅੱਗੀਆਂ ਪੀੜ੍ਹੀਆਂ ਦੇ ਵਿੱਚ ਅੱਗੇ ਖੋਜ ਕਰ ਲਈ ਜਾਵੇਗੀ